ਹੈਲੋ ਸਰ ਕੀ ਤੁਸੀਂ ਟਰਾਂਸਪੋਟ ਏਜੰਸੀ ਬਲਾਚੋਰ ਤੋਂ ਗੱਲ ਕਰ ਰਹੇ ਹੋ ਮੈਂ ਪਿਛਲੇ ਕੁਝ ਦਿਨਾਂ ਕੁਝ ਦਿਨ ਪਹਿਲਾਂ ਹੀ ਤੁਹਾਡੀ ਟਰਾਂਸਪੋਟ ਏਜੰਸੀ ਬਲਾਚੋਰ ਤੋਂ ਇੱਕ ਕੈਬ ਬੁੱਕ ਕਰਵਾਈ ਸੀ ਜਿਸ ਜਿਸ ਉੱਤੇ ਮੈਂ ਬਲਾਚੋਰ ਤੋਂ ਦਿੱਲੀ ਜਾਣਾ ਸੀ ਅਤੇ ਇਹ ਸਮਾਂ ਕੋਵਿਡ ਦਾ ਸਮਾਂ ਹੈ ਅਤੇ ਉਸ ਸਮੇਂ ਤੁਹਾਡੇ ਡਰਾਈਵਰ ਨੇ ਨਾ ਹੀ ਮਾਸਕ ਪਾਇਆ ਹੋਇਆ ਸੀ ਅਤੇ ਤੁਹਾਡੀ ਟੈਕਸੀ ਦੀ ਵੀ ਹਾਲਤ ਬਹੁਤ ਹੀ ਖਰਾਬ ਸੀ ਕਿਉਂਕਿ ਜਦੋਂ ਮੈਂ ਟੈਕਸੀ ਕੋਲ ਜਾ ਕੇ ਦੇਖਿਆ ਤਾਂ ਟੈਕਸੀ ਬਾਹਰੋਂ ਵੀ ਬਹੁਤ ਗੰਦੀ ਸੀ ਅਤੇ ਅਤੇ ਜਦੋਂ ਮੈਂ ਟੈਕਸੀ ਖੋਲ੍ਹੀ ਤਾਂ ਅੰਦਰਲੀਆਂ ਸੀਟਾਂ ਵੀ ਬੁਰੀ ਤਰ੍ਹਾਂ ਫਟੀਆਂ ਹੋਈਆਂ ਸਨ ਅਤੇ ਸੀਟਾਂ ਦੇ ਉੱਤੇ ਕੁਝ ਕੋਕ ਦੀਆਂ ਬੋਤਲਾਂ ਅਤੇ ਖਾਲੀ ਰੈਪਰ ਪੜੇ ਪਏ ਹੋਏ ਸਨ ਜਿ ਜਿਸ ਕਰਕੇ ਗੱਡੀ ਦੀ ਹਾਲਤ ਹੋਰ ਵੀ ਖਰਾਬ ਲੱਗ ਰਹੀ ਸੀ ਅਤੇ ਡਰਾਈਵਰ ਦਾ ਰਵੱਈਆ ਬਹੁਤ ਹੀ ਨੋਨ ਸੀਰੀਅਸ ਸੀ ਉਹ ਬਹੁਤ ਹੀ ਗਾਲ਼ਾਂ ਵਾਲੀ ਬੋਲੀ ਯੂਜ਼ ਕਰ ਰਿਹਾ ਸੀ ਉਸ ਤੋਂ ਇਲਾਵਾ ਉਸ ਉਸਨੇ ਸ਼ਰਾਬ ਵੀ ਪੀਤੀ ਹੋਈ ਸੀ ਅਤੇ ਨਾ ਹੀ ਉਸਨੇ ਮਾਸਕ ਲਗਾਇਆ ਹੋਇਆ ਸੀ ਜਿਸ ਕਰਕੇ ਇਹ ਜਿਸ ਕਰਕੇ ਮੈਂ ਤੁਹਾਨੂੰ ਇਹ ਸ਼ਿਕਾਇਤ ਕਰਨਾ ਚਾਹੁੰਦੀ ਹਾਂ ਕਿ ਆਪਣੇ ਡਰਾਈਵਰ ਕਿ ਆਪਣੇ ਡਰਾਈਵਰ ਨੂੰ ਜਦੋਂ ਵੀ ਤੁਸੀਂ ਰੱਖੋ ਤਾਂ ਉਹਨਾਂ ਦੀ ਯੋਗਤਾ ਯੋਗਤਾ ਦੇਖ ਕੇ ਅਤੇ ਉਹਨਾਂ ਦੀ ਪੂਰੀ ਤਰ੍ਹਾਂ ਜਾਣਕਾਰੀ ਲੈ ਕੇ ਹੀ ਰੱਖੋ ਤਾਂ ਕਿ ਤੁਹਾਡੇ ਅਤੇ ਤੁਹਾਡੀ ਕੰਪਨੀ ਨੂੰ ਕੋਈ ਨੁਕਸਾਨ ਨਾ ਹੋਵੇ